ਇੱਕ ਸੌ ਗਿਆਰਾਂ ਇੱਕ ਹਜ਼ਾਰ ਤਿੰਨ ਸੌ ਇੱਕ ਦਸ ਹਜ਼ਾਰ ਬਾਰਾ ਇੱਕ ਲੱਖ ਵੀਹ ਹਜ਼ਾਰ ਪੱਚੀ ਤੇਰਾਂ ਲੱਖ ਚਾਲੀ ਹਜ਼ਾਰ ਪੰਜ ਸੌ ਤੀਹ ਨੌ ਲੱਖ ਨੜਿਨਵੇਂ ਹਜ਼ਾਰ ਨੌ ਸੌ ਨੜਿਨਵੇਂ